ਮੈਨੂੰ ਅਜੇ ਵੀ ਯਾਦ ਹਨ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਉਦੋਂ ਮੈਂ ਆਪਣੇ ਪਿੰਡ ਵਿੱਚ ਬੜੀ ਜ਼ਿਆਦਾ ਖੇਡਾਂ ਖੇਡਦਾ ਸੀ ਜਿਹਦੇ ਵਿੱਚ ਇੱਕ ਤਾਂ ਗੁੱਲੀ ਡੰਡਾ ਹੁੰਦੀ ਅਤੇ ਇੱਕ ਸਟੱਪੂ ਹੁੰਦਾ ਸੀ ਗੁੱਲੀ ਡੰਡਾ ਵਿੱਚ ਸਾਡੇ ਕੋਲ ਦੋ ਸੋਟੀਆਂ ਹੁੰਦੀਆਂ ਸੀ ਇੱਕ ਵੱਡੀ ਸੋਟੀ ਅਤੇ ਇੱਕ ਛੋਟੀ ਸੋਟੀ ਅਤੇ ਆਪਾਂ ਕੋਸ਼ਿਸ਼ ਕਰਦੇ ਸੀ ਕਿ ਵੱਡੀ ਸੋਟੀ ਨਾਲ ਸੋਟੀ ਛੋਟੀ ਸੋਟੀ ਨੂੰ ਜਿੰਨੀ ਦੂਰ ਹੋ ਸਕੇ ਓਨੀ ਦੂਰ ਸੁੱਟੀਏ ਅਤੇ ਫੇਰ ਆਪਾਂ ਉਹਨੂੰ ਉਹ ਤੋਂ ਪਹਿਲੋਂ ਪਹਿਲੋਂ ਆਪਾਂ ਚੀਜ਼ਾਂ ਕਰਨੀਆਂ ਹੁੰਦੀਆਂ ਸੀ ਅਤੇ ਦੂਜੇ ਵੀ ਬੰਦੇ ਨੇ ਉਹ ਸੋਟੀ ਨੂੰ ਜਿੰਨੀ ਛੇਤੀ ਹੋ ਸਕੇ ਓਨੀ ਛੇਤੀ ਲਿਆਉਣਾ ਸੀ ਅਤੇ ਉਸਨੂੰ ਆਪਾਂ ਫੇਰ ਗੁੱਲੀ ਡੰਡਾ ਕਹਿੰਦੇ ਸੀ ਅਤੇ ਦੂਜੀ ਗੇਮ ਤੇ ਹੁੰਦੀ ਸੀ ਸਟਾਪੂ ਜਿਸ 'ਚ ਛੋਟੇ ਛੋਟੇ ਡੱਬੇ ਥੱਲੇ ਫਰਸ਼ 'ਤੇ ਬਣਾ ਦੇਣੇ ਸੀ ਅਤੇ ਇੱਕ ਨਿੱਕੇ ਨਿੱਕਾ ਜਿਹਾ ਪੱਥਰ ਕੋਈ ਵੀ ਡੱਬੇ ਵਿੱਚ ਸੁੱਟਣਾ ਸੀ ਅਤੇ ਫਿਰ ਆਪਾਂ ਹੌਲੀ ਹੌਲੀ ਕਰਕੇ ਇੱਕ ਪੈਰ ਅਤੇ ਇੱਕ ਹਰ ਇੱਕ ਡੱਬਾ ਟੱਪਣਾ ਸੀ ਜਿੱਥੋਂ ਤੱਕ ਆਪਾਂ ਸੁੱਟ ਇਹ ਪੱਥਰ ਸੁੱਟਿਆ ਸੀ ਉੱਥੋਂ ਤੱਕ ਅਤੇ ਆਹ ਆਹ ਖੇਡ ਵਿੱਚ ਤਾਂ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਸੀ ਅਤੇ ਫੇਰ ਇੱਕ ਹੋਰ ਤੀਜੀ ਖੇਡ ਸੀ ਛੂਹਣ ਸਿਪਾਹੀ ਜਿਹਦੇ ਵਿੱਚ ਆਪਾਂ ਦੌੜ ਦੌੜ ਕੇ ਬੱਚਿਆਂ ਨੂੰ ਹੱਥ ਲਾਉਣਾ ਸੀ ਅਤੇ ਉਹਨਾਂ ਨੂੰ ਫੜਨਾ ਸੀ ਤਾਂ ਕਿ ਆਪਾਂ ਫੇਰ ਉਹਨਾਂ ਦੀ ਇਹ 'ਚ ਆਪਾਂ ਛੂਹਣ ਖੇਡਦੇ ਸੀ ਅਤੇ ਮਜ਼ਾ ਤਾਂ ਬਹੁਤ ਹੀ ਜ਼ਿਆਦਾ ਆਉਂਦਾ ਸੀ ਅਤੇ ਆਹ ਗੇਮ ਖੇਡਣ ਨਾ ਨਾਲ ਸਿਰਫ ਆਪਾਂ ਮਜ਼ੇ ਵਾਸਤੇ ਖੇਡਦੇ ਸੀ ਬਲਕਿ ਇਹ ਨਾਲ ਤਾਂ ਸਾਡੀ ਸਿਹਤ ਵੀ ਬਹੁਤ ਹੀ ਵਧੀਆ ਹੁੰਦੀ ਸੀ ਸਾਡਾ ਸਟੈਮੀਨਾ ਵੀ ਵੱਧਦਾ ਸੀ ਅਤੇ ਅਤੇ ਨਾਲ ਹੀ ਹੋਰ ਜਣੇ ਆਹ ਗੇਮ ਨੂੰ ਦੇਖ ਕੇ ਸਾਡੇ ਨਾਲ ਜ਼ਰੂਰ ਖੇਡਣਾ ਚਾਹੁੰਦੇ ਸੀ ਕਿਉੰਕਿ ਜੋ ਮਜ਼ਾ ਬਚਪਨ ਦੀ ਗੇਮਾਂ ਵਿੱਚ ਸੀ ਉਹ ਅੱਜ ਦੀ ਗੇਮਾਂ ਵਿੱਚ ਤਾਂ ਬਹੁਤ ਹੀ ਘੱਟ ਹੈ ਉਹ ਦਿਨ ਦੀ ਗੇਮਾਂ ਵਿੱਚ ਤਾਂ ਸਾਨੂੰ ਐਨਾ ਪਸੀਨਾ ਆਉਂਦਾ ਸੀ ਗੇਮਾਂ ਖੇਡਦੇ ਐਨਾ ਤੇ ਐਨਾ ਮਜ਼ਾ ਵੀ ਆਉਂਦਾ ਸੀ ਜੋ ਕਿ ਅੱਜ ਦੀ ਗੇਮਾਂ ਵਿੱਚ ਤਾਂ ਹੈ ਨਹੀਂ ਅੱਜ ਦੇ ਲੋਕ ਗੇਮਾਂ ਵਿੱਚ ਤਾਂ ਬਹਿ ਕੇ ਫੋਨ 'ਤੇ ਗੇਮਾਂ ਖੇਡ ਲੈਂਦੇ ਸੀ ਪਰ ਬਚਪਨ ਵਿੱਚ ਤਾਂ ਸਾਨੂੰ ਆਪਣੇ ਪੂਰੇ ਸਰੀਰ ਨੂੰ ਹਹ ਹਿਲਾ ਹਿਲਾ ਕੇ ਪਸੀਨਾ ਕੱਢ ਕੱਢ ਕੇ ਖੇਡਣਾ ਪੈਂਦਾ ਸੀ ਜਿਹਦੇ ਵਿੱਚ ਮਜ਼ਾ ਵੀ ਆਉਂਦਾ ਸੀ ਅਤੇ ਹੋਰ ਵੀ ਕਾਫੀ ਗੇਮਾਂ ਸੀ ਬਚਪਨ ਦੀਆਂ ਜਿਹੜੀਆਂ ਬਚਪਨ ਦੇ ਸਰੀਰ ਵਾਸਤੇ ਕਾਫੀ ਵਧੀਆ ਹੁੰਦੀਆਂ ਸੀ ਜਿਹੜੀਆਂ ਕਿ ਅੱਜ ਦੇ ਟਾਈਮ ਵਿੱਚ ਵਿ ਵਿਲੁਪਤ ਹੋਈ ਜਾ ਰਹੀਆਂ ਹਨ ਪਰ ਕੁਛ ਕੁਛ ਲੋਕ ਜ ਅਜੇ ਵੀ ਖੇਡਦੇ ਹਨ ਉਹ ਗੇਮਾਂ ਅਤੇ ਜਦੋਂ ਉਹ ਖੇਡਦੇ ਹਨ ਤਾਂ ਬਹੁਤ ਹੀ ਮਜ਼ਾ ਆਉਂਦਾ ਹੈ ਉਹਨਾਂ ਨੂੰ ਦੇਖ ਕੇ